ਹਾਂਜੀ ਸਾਗ ਜਿਹੜੀ ਕਿ ਇਹ ਜੀ ਸਬਜ਼ੀ ਹੈ ਜਿਹੜੀ ਕਿ ਸਾਡੀ ਪੀੜ੍ਹੀਆਂ ਤੋਂ ਪੀੜ੍ਹੀਦਰ ਚੱਲਦੀ ਆ ਰਹੀ ਹੈ ਅਤੇ ਇਹ ਜਿਹੜੀ ਸਬਜ਼ੀ ਹੁੰਦੀ ਹੈ ਇਹ ਹਰੇ ਉਹਦੀ ਬਣਾਈ ਜਾਂਦੀ ਹੈ ਸਾਰਾ ਕੁਛ ਹਰਾ ਜਿਹੜੀਆਂ ਸਬਜ਼ੀਆਂ ਉਹ ਇਹਦੇ 'ਚ ਪਾਈਆਂ ਜਾਂਦੀਆਂ ਜਿਹਦੇ ਨਾਲ਼ ਆਪਣੀ ਸਿਹਤ ਵੀ ਚੰਗੀ ਰਹਿੰਦੀ ਹੈ ਅਤੇ ਆਪਣਾ ਖਾਣ 'ਚ ਵੀ ਸਵਾਦ ਇਹਦਾ ਵਧੀਆ ਹੁੰਦਾ ਹੈ ਜਿਸ ਨਾਲ਼ ਆਪਾਂ ਨੂੰ ਵਧੀਆ ਜਿਹੜਾ ਕਿ ਲੱਗਦਾ ਹੈ ਅਤੇ ਪਿੱਛੇ ਤੋਂ ਚੱਲਦੀ ਆ ਰਹੀ ਆ ਤਾਂ ਇਹ ਵਧੀਆ ਹੀ ਹੋਵੇਗੀ